ਮੇਰੀ ਸਭ ਤੋਂ ਜ਼ਿਆਦਾ ਮਨਪਸੰਦ ਰੈਸਪੀ ਹੈ ਦਹੀਂ ਮਿਰਚ ਵਾਲੀ ਸ਼ਿਮਲਾ ਮਿਰਚ ਆਮ ਆਮ ਘਰਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਸੇ ਵੀ ਸਬਜ਼ੀ ਵਿੱਚ ਜਾਂ ਦਾਲਾਂ ਵਗੈਰਾ ਦੇ ਵਿੱਚ ਕਿਸੇ ਵੀ ਸਬਜ਼ੀ ਦੇ ਵਿੱਚ ਦੁੱਧ ਦਹੀਂ ਬੇਸਣ ਵਗੈਰਾ ਆਦਿ ਨਹੀਂ ਪੈਂਦਾ ਪਰ ਜਿਹੜੀ ਮੇਰੀ ਮਨਪਸੰਦ ਸਬਜ਼ੀ ਹੈ ਦਹੀਂ ਵਾਲੀ ਸ਼ਿਮਲਾ ਮਿਰਚ ਉਹਦੇ ਵਿੱਚ ਇਹ ਸਭ ਚੀਜ਼ਾਂ ਪੈਂਦੀਆਂ ਹਨ ਜਿਵੇਂ ਕਿ ਸ਼ਿਮਲਾ ਉਹਦੇ ਵਿੱਚ ਕੀ ਹੁੰਦਾ ਹੈ ਆ ਸ਼ਿਮਲਾ ਦੇ ਵਿੱਚ ਜਿਹੜੀ ਸਭ ਤੋਂ ਅਲੱਗ ਚੀਜ਼ਾਂ ਨੇ ਉਹ ਹੁੰਦਾ ਹੈ ਦਹੀਂ ਪਾਉਣੀ ਖੱਟੀ ਦਹੀਂ ਉਸ ਤੋਂ ਬਾਅਦ ਬੇਸਣ ਪਾਉਣਾ ਅਤੇ ਆਪਣਾ ਹੁੰਦਾ ਬਾਕੀ ਕਸੂਰੀ ਮੇਥੀ ਪਾਉਣੀ ਆਮ ਘਰਾਂ ਦੇ ਵਿੱਚੋਂ ਦਹੀਂ ਅਤੇ ਬੇਸਣ ਦਾ ਸਬਜ਼ੀ ਬਣਾਉਣ ਦੇ ਵਿੱਚ ਇਸਤੇਮਾਲ ਨਹੀਂ ਹੁੰਦਾ ਅਤੇ ਇਹਦੇ ਵਿੱਚ ਕਾਫੀ ਮਸਾਲਿਆਂ ਦਾ ਇਸਤੇਮਾਲ ਹੁੰਦਾ ਆ ਜਿਵੇਂ ਆਮ ਲੋਕਾਂ ਘਰਾਂ ਦੇ ਵਿੱਚ ਲੋਕ ਕੀ ਕਰਦੇ ਹਨ ਟਮਾਟਰ ਲਸਣ ਵਗੈਰਾ ਆਦੀ ਨੂੰ ਕੁੱਟ ਕੇ ਪਾਉਂਦੇ ਹਨ ਪਰ ਉਹ ਦਹੀਂ ਦਹੀਂ ਵਾਲੇ ਸ਼ਿਮਲਾ ਮਿਰਚ ਦੇ ਵਿੱਚ ਕੁੱਟ ਕੇ ਨਹੀਂ ਪੈਂਦੇ ਸਾਬਤੇ ਹੀ ਉਹਨਾਂ ਚੀਜ਼ਾਂ ਨੂੰ ਆਪਣਾ ਸਬਜ਼ੀ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਅਤੇ ਇੱਕ ਇਹ ਬਹੁਤ ਜ਼ਿਆਦਾ ਸਵਾਦ ਸਵਾਦ ਭਰੀ ਸਬਜ਼ੀ ਤਿਆਰ ਹੁੰਦੀ ਹੈ ਦੁੱਧ ਵੀ ਇਹਦੇ ਵਿੱਚ ਅਸੀਂ ਪਾ ਸਕਦੇ ਹਾਂ ਖੱਟੀ ਦਹੀਂ ਪਾ ਸਕਦੇ ਹਾਂ ਬੇਸਣ ਪਾ ਸਕਦੇ ਹਾਂ ਅਤੇ ਇਸ ਤੋਂ ਇਲਾਵਾ ਅਸੀਂ ਜਿਹੜੀ ਬੜੀਆਂ ਦੀ ਸਬਜ਼ੀ ਹੁੰਦੀ ਹੈ ਬੜੀਆਂ ਦੀ ਸਬਜ਼ੀ ਦੇ ਵਿੱਚ ਵੀ ਦਹੀਂ ਦਾ ਇਸਤੇਮਾਲ ਕਰ ਸਕਦੇ ਹਾਂ ਟਮਾ ਟਮਾਟਰ ਇਹਦੀ ਚਟਨੀ ਵਿੱਚ ਪਾ ਸਕਦੇ ਹਾਂ ਕਾਫੀ ਚੀਜ਼ਾਂ ਨੇ ਜੋ ਇਹ ਸਬਜ਼ੀ ਬਣਾਉਣ ਲਈ ਇਸਤੇਮਾਲ ਹੁੰਦੀਆਂ ਨੇ ਅਤੇ ਇਹ ਸਬਜ਼ੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਵਾਦ ਭਰੀ ਹੁੰਦੀ ਹੈ ਅਤੇ ਮੇਰੇ ਘਰ ਦੇ ਸਬਜ਼ੀ ਨੂੰ ਬਹੁਤ ਖੁਸ਼ ਹੋ ਕੇ ਖਾਂਦੇ ਹਨ